ਸਤਿ ਸ਼੍ਰੀ ਅਕਾਲ ਜੀ ਕੀ ਤੁਸੀਂ ਸਾਰਿਆਂ ਨਾਲ ਖਾਣਾ ਖਾਣਾ ਪਸੰਦ ਕਰਦੇ ਹੋ ਹਾਂ ਮੈਂ ਸਾਰਿਆਂ ਨਾਲ ਖਾਣਾ ਖਾਣਾ ਪਸੰਦ ਕਰਦੀ ਹਾਂ ਜਿਵੇਂ ਕਿ ਰਾਤ ਨੂੰ ਹੀ ਅਸੀਂ ਸਾਰੇ ਇਕੱਠੇ ਹੁੰਦੇ ਹਾਂ ਬੱਚੇ ਤਾਂ ਸਵੇਰੇ ਸਕੂਲ ਗਏ ਹੁੰਦੇ ਨੇ ਅਤੇ ਘਰ ਵਾਲੇ ਵੀ ਕੰਮਾਂ 'ਤੇ ਗਏ ਹੁੰਦੇ ਨੇ ਇਸ ਲਈ ਅਸੀਂ ਰਾਤ ਨੂੰ ਸਾਰੇ ਜਾਣੇ ਇਕੱਠੇ ਹੁੰਦੇ ਹਾਂ ਅਤੇ ਅਸੀਂ ਇਕੱਠੇ ਖਾਣਾ ਖਾਣਾ ਪਸੰਦ ਕਰਦੇ ਹਾਂ ਰਾਤ ਨੂੰ ਅਸੀਂ ਸਾਰੇ ਇਕੱਠੇ ਹੀ ਬਹਿ ਕੇ ਰੋਟੀ ਖਾਂਦੇ ਹਾਂ ਇਕੱਠ ਇਕੱਠ ਵਿੱਚ ਅਸੀਂ ਇੱਕ ਇੱਕ ਵਾਰੀ ਅਸੀਂ ਅਖੰਡ ਪਾਠ ਕਰਵਾਇਆ ਸੀ ਜਿਹਦੇ ਵਿੱਚ ਕਿ ਮੈਂ ਤਿੰਨ ਦਿਨ ਬਾਬਾ ਜੀ ਦੀ ਬਹੁਤ ਤਨ ਮਨ ਦੇ ਨਾਲ ਸੇਵਾ ਕੀਤੀ ਸੀ ਸਾਡੇ ਘਰ ਗੁਰੂ ਗ੍ਰੰਥ ਸਾਹਿਬ ਜੀ ਆਏ ਸੀ ਬਾਬਾ ਜੀ ਦੀ ਮੈਂ ਬਹੁਤ ਸੇਵਾ ਕੀਤੀ ਸੀ ਜਿਹਦੇ ਵਿੱਚ ਪਹਿਲੇ ਤਾਂ ਦੋ ਦਿਨ ਮੈਂ ਆਪਣੇ ਹੱਥਾਂ ਨਾਲ ਖੁਦ ਲੰਗਰ ਬਣਾ ਕੇ ਸੰਗਤ ਨੂੰ ਛਕਾਉਂਦੀ ਰਹੀ ਸਾਂ ਦੋ ਦਿਨ ਮੈਂ ਬਹੁਤ ਵਧੀਆ ਲੰਗਰ ਦੀ ਸੇਵਾ ਕੀਤੀ ਜਿਹੜਾ ਵੀ ਕੋਈ ਸਾਡੇ ਘਰ ਮੱਥਾ ਟੇਕਣ ਬਾਬਾ ਜੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਨਮਸਕਾਰ ਕਰਨ ਆਉਂਦਾ ਸੀ ਮੈਂ ਉਹਨਾਂ ਨੂੰ ਦੁਪਹਿਰੇ ਵੀ ਰੋਟੀ ਖਵਾਉਂਦੀ ਸਾਂ ਅਤੇ ਰਾਤ ਨੂੰ ਵੀ ਰੋਟੀ ਖਵਾਉਂਦੀ ਸਾਂ ਸਾਰੇ ਬਹੁਤ ਵਧੀਆ ਮਤਲਬ ਕਿ ਰੋਟੀ ਖਾ ਕੇ ਆਨੰਦ ਮਾਣਦੇ ਸੀ ਅਤੇ ਫਿਰ ਅਗਲੇ ਦਿਨ ਤੀਸਰੇ ਦਿਨ ਜਦੋਂ ਅਖੰਡ ਪਾਠ ਦਾ ਭੋਗ ਸੀ ਉਸ ਦਿਨ ਸਾਡੇ ਘਰ ਬਹੁਤ ਇਕੱਠ ਇਕੱਠਾ ਹੋਇਆ ਸੀ ਅਤੇ ਅਸੀਂ ਉਸ ਦਿਨ ਉਸ ਦਿਨ ਤਾਂ ਮੇਰੇ ਕੋਲੋਂ ਟਾਈਮ ਨਹੀਂ ਸੀ ਕਿ ਮੈਂ ਸਾਰਿਆਂ ਲਈ ਇੰਨਾਂ ਲੰਗਰ ਪਾਣੀ ਤਿਆਰ ਕਰ ਸਕਾਂ ਫਿਰ ਅਸੀਂ ਆਪਣੇ ਘਰ ਹਲਵਾਈ ਲਾਏ ਸੀ ਫਿਰ ਮੇਰੇ ਤਾਂ ਘਰ ਦੇ ਹਲਵਾਈਆਂ ਦੇ ਕੋਲ ਖੜ੍ਹੇ ਰਹੇ ਫਿਰ ਮੈਨੂੰ ਉਹਨਾਂ ਨੇ ਲੰਗਰ ਬਾਲਟੀਆਂ 'ਚ ਪਾ ਕੇ ਲਿਆ ਕੇ ਦਿੱਤਾ ਜੋ ਕਿ ਮੈਂ ਸਾਰੀ ਸੰਗਤ ਨੂੰ ਇਕੱਠ ਨੂੰ ਲੰਗਰ ਖਵਾਇਆ ਜੋ ਕਿ ਮੈਨੂੰ ਬਹੁਤ ਵਧੀਆ ਲੱਗਾ ਕਿ ਮੈਂ ਉਹਨਾਂ ਨੂੰ ਇਕੱਠ ਨੂੰ ਲੰਗਰ ਛਕਾਇਆ ਸੰਗਤ ਦੀ ਸੇਵਾ ਕੀਤੀ ਮੇਰੇ ਮਨ ਨੂੰ ਬਹੁਤ ਸਕੂਨ ਮਿਲਿਆ ਅਤੇ ਮੈਂ ਸਾਰਿਆਂ ਨੂੰ ਲੰਗਰ ਛਕਾਇਆ ਫਿਰ ਉਸ ਤੋਂ ਬਾਅਦ ਮੈਂ ਆਪਣੇ ਘਰਦਿਆਂ ਨੂੰ ਲੰਗਰ ਛਕਾਇਆ ਜਦੋਂ ਸਾਡੇ ਘਰੋਂ ਸਾਰੀ ਸੰਗਤ ਚਲੀ ਗਈ ਫਿਰ ਅਸੀਂ ਸਾਰਿਆਂ ਨੇ ਇਕੱਠਿਆਂ ਬਹਿ ਕੇ ਲੰਗਰ ਛਕਿਆ ਜੋ ਕਿ ਸਾ ਹਲਵਾਈਆਂ ਨੇ ਵੀ ਬਹੁਤ ਵਧੀਆ ਲੰਗਰ ਬਣਾਇਆ ਸੀ ਅਸੀਂ ਸਾਰਿਆਂ ਨੇ ਇਕੱਠਿਆਂ ਫਿਰ ਉਹਨਾਂ ਦੇ ਜਾਣ ਤੋਂ ਬਾਅਦ ਮੈਂ ਆਪਣੇ ਘਰ ਦਾ ਸਾਰੀ ਸਾਫ਼ ਸਫਾਈ ਕੀਤੀ ਧੰਨਵਾਦ